ਹਾਂਜੀ ਸਾਡੇ ਇਲਾਕੇ ਵਿੱਚ ਸੈਲਾਨੀ ਆ ਆਕਰਸ਼ਣ ਲਈ ਬਹੁਤ ਥਾਵਾਂ ਹਨ ਜਿੱਦਾਂ ਕਿ ਸਾਡੇ ਪਿਆਰੇ ਪਾਰਕ ਹੋ ਗਏ ਜਿੱਦਾਂ ਕਿ ਨਹਿਰਾਂ ਖੇਤਰ ਪਾਰਕ ਤਾਂ ਸਾਡੇ ਇਲਾਕੇ ਵਿੱਚ ਇੱਦਾਂ ਹਨ ਬਹੁਤ ਸੋਹਣੇ ਸੋਹਣੇ ਪਾਰਕ ਹੈ ਜਿੱਥੇ ਸਵੇਰੇ ਸਵੇਰੇ ਇੰਨੇ ਸਾਫ਼ ਰੱਖੇ ਦੇ ਹੁੰਦੇ ਇੰਨੇ ਸਾਫ਼ ਪਾਰਕ ਹੈਗੇ ਤੁਸੀਂ ਜਾਓਗੇ ਤਾਂ ਤੁਹਾਡਾ ਦਿਲ ਖੁਸ਼ ਹੋ ਜਾਂਦਾ ਤੁਸੀਂ ਕਹਿਣਾ ਵਾਹ ਇਹ ਬਹੁਤ ਵਧੀਆ ਚੀਜ਼ ਹੈ ਨ ਪਾਰਕਾਂ 'ਚ ਲੋਕ ਆ ਜਾਂਦੇ ਸਵੇਰੇ ਸਵੇਰੇ ਘੁੰਮਣ ਫਿਰਨ ਹੈ ਨਾ ਓਰ ਮੈਨੂੰ ਇੱਦਾਂ ਲੱਗਦਾ ਹੈ ਕਿ ਜਿੱਦਾਂ ਜਿੱਦਾਂ ਜਿਹੜੇ ਸੈਲਾਨੀ ਆਕਰਸ਼ਣ ਆ ਉਹ ਇੱਕ ਪਿੰਡ ਵਿੱਚ ਹੋਣਾ ਹੀ ਚਾਹੀਦਾ ਪਿੰਡ ਵਾਲਿਆਂ ਦਾ ਧਿਆਨ ਭਟਕਦਾ ਰਹਿੰਦਾ ਔਰ ਪਾਰਕ ਵਗੈਰਾ ਸ਼ਹਿਰਾਂ ਵਿੱਚ ਵੀ ਬਹੁਤ ਅੱਜ ਕੱਲ੍ਹ ਬਣ ਗਿਆ ਸਾਡੇ ਦੇਸ਼ ਨੇ ਬਹੁਤ ਤਰੱਕੀ ਕਰ ਲਈ ਹੈ ਸੈਲਾਨੀ ਆਕਰਸ਼ਣ ਵਿੱਚ ਵਿਦੇਸ਼ ਵਿਦੇਸ਼ ਵਾਲੇ ਲੋਕ ਆ ਰਹੇ ਆ ਸਾਡੇ ਦੇਸ਼ ਵਿੱਚ ਸਾਡੇ ਦੇਸ਼ ਦਾ ਸੱਭਿਆਚਾਰ ਜਾਨਣ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਧੰਨ